ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਕੇਂਦਰ ਸਰਕਾਰ ਦੀ ਯੋਜਨਾ ਹੈ ਇਸ ਯੋਜਨਾ ਨੂੰ ਕੇਂਦਰ ਸਰਕਾਰ ਦੁਆਰਾ ਮਿਡ ਡੇ ਮੀਲ ਯੋਜਨਾ ਜੋ ਕਿ ਮੌਜੂਦਾ ਰਾਸ਼ਟਰੀ ਕੇਂਦਰ ਸਰਕਾਰ ਦੀ ਯੋਜਨਾ ਹੈ ਉਸ ਦਾ ਸਥਾਨ ਲੈਣ ਲਈ ਬਣਾਇਆ ਗਿਆ ਹੈ ਇਸ ਨੂੰ ਦੋ ਹਜ਼ਾਰ ਇੱਕੀ ਬਾਈ ਤੋਂ ਦੋ ਹਜ਼ਾਰ ਪੱਚੀ ਛੱਬੀ ਦੇ ਸ਼ੁਰੂਆਤੀ ਸਮੇਂ ਵਿੱਚ ਲਾਂਚ ਕੀਤਾ ਗਿਆ ਇਸ ਵਿੱਚ ਪੱਕਿਆ ਹੋਇਆ ਖਾਣਾ ਸਕੂਲਾਂ ਵਿੱਚ ਪਹੁੰਚਾਉਣ ਲਈ ਕਿਹਾ ਗਿਆ ਹੈ ਇਹ ਇੱਕ ਤੋਂ ਅੱਠਵੀਂ ਤੱਕ ਪੜ੍ਹਨ ਵਾਲੇ ਚੌਦਾਂ ਵਰਸ਼ ਤੱਕ ਦੇ ਬੱਚਿਆਂ ਲਈ ਹੈ ਉਹਨਾਂ ਨੂੰ ਪੱਕਿਆ ਹੋਇਆ ਖਾਣਾ ਉਪਲਬਧ ਕਰਵਾਉਣ ਲਈ ਹੈ